ਜਿਵੇਂ ਕਿ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਹਾਂ ਗੱਤਕਾ ਸ਼ਾਸਤਰ ਦਾ ਸਾਡੇ ਧਰਮ ਵਿੱਚ ਗਿਆਨ ਦਿੱਤਾ ਜਾਂਦਾ ਹੈ ਮੈਂ ਵੀ ਆਪਣੇ ਨਜ਼ਦੀਕੀ ਗੁਰਦੁਆਰਾ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿੱਚ ਸ਼ਸਤਰ ਵਿਦਿਆ ਲੈਂਦਾ ਰਿਹਾ ਹਾਂ ਜਿਸ ਨੂੰ ਗੱਤਕਾ ਕਿਹਾ ਜਾਂਦਾ ਹੈ ਸ਼ਸਤਰ ਵਿਦਿਆ ਦੇ ਖਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲਿਆ ਤੀਜੇ ਗੁਰੂ ਅਮਰਦਾਸ ਜੀ ਨੇ ਧਿਆਨ ਸਿਮਰਨ ਮੁੱਖ ਰੱਖਿਆ ਤੇ ਮੱਲ ਅਖਾੜੇ ਦੀ ਵਿਰਾਸਤ ਨੂੰ ਸੰਭਾਲਿਆ ਛੇਵੇਂ ਗੁਰੂ ਸਾਹਿਬਾਨ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਇਸ ਕਰਕੇ ਸ਼ਾਸਤਰ ਵਿੱਦਿਆ ਪ੍ਰਾਪਤ ਕਰਨਾ ਹਰੇਕ ਸਿੱਖ ਬੱਚੇ ਦਾ ਮੁੱਢਲਾ ਧਰਮ ਹੈ ਬਾਬਾ ਜੀ ਦੇ ਸਮੇਂ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਹਰਗੋਬਿੰਦ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੱਤਕਾ ਸਿਖਲਾਈ ਦਿੱਤੀ ਜਾਣ ਦਿੱਤੀ ਜਾਣ ਲਈ ਅਖਾੜਾ ਖੋਲਿਆ ਮੁਕਾਬਲੇ ਵੀ ਕਰਵਾਏ ਜਾਣ ਲੱਗੇ ਗੁਰੂ ਸਾਹਿਬ ਜੀ ਨੇ ਵੀ ਘੋੜ ਸਵਾਰੀ ਦੇ ਨਾਲ ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇ ਬਾਜ ਨੂੰ ਪਹਿਲ ਦਿੱਤੀ ਜਾਂਦੀ ਸੀ ਜਿਵੇਂ ਕਿ ਅੱਜ ਦੇ ਟਾਈਮ ਵਿੱਚ ਨਗਰ ਕੀਰਤਨਾ ਵਿੱਚ ਗੱਤਕਾ ਪੇਸ਼ ਕੀਤਾ ਜਾਂਦਾ ਹੈ ਪੰਜਾਬੀ ਗੱਭਰੂ ਮੁੰਡੇ ਸਿੱਖ ਧਰਮ ਨਾਲ ਬਿਲੋਂਗ ਗੱਤਕਾ ਖੇਡਦੇ ਹਨ ਅਤੇ ਆਪਣੇ ਜੋਹਰ ਦਿਖਾਉਂਦੇ ਹਨ ਇਸ ਵਿੱਚ ਭਿੰਨ ਭਿੰਨ ਪ੍ਰਕਾਰ ਦੀ ਸ਼ਸਤਰ ਵਿੱਦਿਆ ਦਾ ਅਧਿਐਨ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੇ ਸ਼ਸਤਰ ਵਰਤੇ ਜਾਂਦੇ ਹਨ ਜਿਵੇਂ ਖੰਡਾ ਤਲਵਾਰ ਬਾਹਰ ਝਾੜ ਡਾਂਗ ਇਸ ਵਿੱਚ ਸ਼ਾਮਿਲ ਹੁੰਦੇ ਹਨ ਸਾਡੇ ਗੁਰੂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ਼ਸਤਰ ਵਿਦਿਆ ਨੂੰ ਮੁੱਖ ਰੱਖਦਿਆਂ ਹਰੇਕ ਸਿੱਖ ਦਾ ਮੁਢਲਾ ਧਰਮ ਦੱਸਿਆ ਹੈ ਗੱਤਕਾ ਵਿਦਿਆ ਨੂੰ ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਗੱਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਹੈ ਜਿਸ ਥਾਂ ਤੇ ਗੱਤਕਾ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ ਅਖਾੜਾ ਕਿਹਾ ਜਾਂਦਾ ਹੈ ਸਿੱਖ ਮਿਸਲਾਂ ਦੀ ਹੋਂਦ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਅਜਿਹਾ ਹੁੰਦਾ ਰਿਹਾ ਹੈ ਇਸ ਕਰਕੇ ਗੱਤਕਾ ਵਿੱਦਿਆ ਸਿੱਖ ਧਰਮ ਨਾਲ ਬਿਲੋਂਗ ਸਾਰੇ ਬੱਚਿਆਂ ਨੂੰ ਸਿੱਖਣਾ ਜਰੂਰੀ ਹੈ ਮੈਂ ਵੀ ਆਪਣੇ ਟਾਈਮ ਵਿੱਚ ਗੱਤਕਾ ਖੇਡਦਾ ਰਿਹਾ ਹਾਂ ਕਈ ਮੁਕਾਬਲੇ ਵੀ ਮੈਂ ਜਿੱਤੇ ਹਨ ਮੇਰੇ ਕੋਲਾਂ ਅਨੇਕਾਂ ਪ੍ਰਕਾਰ ਦੇ ਮੈਡਲ ਗੱਤਕਾ ਵਿਦਿਆ ਨਾਲ ਸੰਬੰਧਿਤ ਪਏ ਹਨ ਜੋ ਕਿ ਮੇਰੀ ਵਿਦਿਆ ਨੂੰ ਦਰਸਾਉਂਦੇ ਹਨ ਧੰਨਵਾਦ